ਸਟੇਟ ਸਰਕਾਰੀ ਹੋਸਪੀਟਲ ਦੇ ਵਿੱਚ ਵੱਧ ਰਹੇ ਭੀੜ ਭੜੱਕੇ ਦੀ ਹੱਲ ਕਰਨ ਲਈ ਬਹੁਤ ਵੱਡੇ ਅਤੇ ਵਧੀਆ ਉਪਰਾਲੇ ਕਰ ਰਿਹਾ ਹੈ ਜਿਵੇਂ ਕਿ ਔਨਲਾਈਨ ਬੁਕਿੰਗ ਕਰਨਾ ਟੋਕਨ ਸਿਸਟਮ ਜਿਸ ਨਾਲ਼ ਕਿ ਕੋਈ ਵੀ ਮਰੀਜ਼ ਹੈ ਉਹ ਜਿਵੇਂ ਕਿ ਚਲੇ ਜਾਂਦੇ ਉੱਠ ਕੇ ਅੱਗੇ ਉਹਨਾਂ ਨੂੰ ਡਾਕਟਰ ਨਹੀਂ ਮਿਲਦਾ ਹੈ ਤਾਂ ਉਹਨਾਂ ਨੂੰ ਟੋਕਨ ਸਿਸਟਮ ਦੇ ਰਾਹੀਂ ਡੇਟ ਦਿੱਤੀ ਜਾਂਦੀ ਹੈ ਵੀ ਇਸ ਡੇਟ ਨੂੰ ਤੁਸੀਂ ਇਸ ਸਮੇਂ ਜਿਸ ਜਗ੍ਹਾ 'ਤੇ ਵੀ ਇਲਾਜ ਉਹਨਾਂ ਦਾ ਹੋਣਾ ਹੈ ਤਾਂ ਉੱਥੇ ਉਹਨਾਂ ਨੂੰ ਉਸ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਇਸ ਦੇ ਲਈ ਬਹੁਤ ਹੀ ਵੱਡੇ ਵੱਡੇ ਮਾਹਿਰਾਂ ਨਾਲ਼ ਵੀ ਗੱਲਬਾਤ ਹੋ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ